ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਪਿਛਲੇ ਕਈ ਸਦੀਆਂ ਤੋਂ ਇਹ ਚੱਲਦਾ ਆ ਰਿਹਾ ਹੈ ਭੰਗੜੇ ਇੰਨਾਂ ਜ਼ਿਆਦਾ ਮਸ਼ਹੂਰ ਹੋ ਗਿਆ ਹੈ ਕਿ ਅੱਜ ਕੱਲ੍ਹ ਦੇ ਕੁੜੀਆਂ ਮੁੰਡੇ ਇਹ ਨਾਚ ਬਹੁਤ ਹੀ ਸ਼ੌਂਕ ਨਾਲ ਕਰਦੇ ਸਨ ਇਹ ਨਾਚ ਇੰਨਾਂ ਜ਼ਿਆਦਾ ਪ੍ਰਸਿੱਧ ਹੋ ਗਿਆ ਕਿ ਇਹ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਪ੍ਰਸਿੱਧ ਹੈ ਇਹ ਨਾਚ ਹਰ ਜਗ੍ਹਾ 'ਤੇ ਪਾਇਆ ਜਾਂਦਾ ਹੈ ਪਹਿਲਾਂ ਕਈ ਲੋਕ ਇਸ ਨੂੰ ਦੀਵਾਲੀ ਹੋਲੀ ਜਾਂ ਕਈ ਤਰ੍ਹਾਂ ਦੇ ਤਿਉਹਾਰ ਜਿਵੇਂ ਕਿ ਵਿਸਾਖੀ ਦਾ ਮੇਲਾ ਜਰਗ ਦਾ ਮੇਲਾ ਆਦੀ ਉੱਤੇ ਪਾਉਂਦੇ ਸਨ ਪਰੰਤੂ ਹੁਣ ਇਹ ਇੰਨੇ ਜ਼ਿਆਦਾ ਪ੍ਰਸਿੱਧ ਹੋ ਚੁੱਕਿਆ ਹੈ ਕਿ ਕਿ ਇਹ ਹਰ ਇੱਕ ਮੌਕੇ 'ਤੇ ਮਨਾਇਆ ਜਾਂਦਾ ਹੈ ਜਿਵੇਂ ਕਿ ਸਮੇਂ ਦੇ ਨਾਲ ਨਾਲ ਇਸ ਵਿੱਚ ਕਈ ਤਬਦੀਲੀਆਂ ਆਈਆਂ ਇਹ ਵਿਆਹ ਸ਼ਾਦੀਆਂ ਫੰਕਸ਼ਨਾਂ ਕਈ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ 'ਤੇ ਵੀ ਪਾਇਆ ਜਾਂਦਾ ਹੈ ਕਿਉਂਕਿ ਭੰਗੜਾ ਪੰਜਾਬੀਆਂ ਦਾ ਸਭ ਤੋਂ ਮਹੱਤਵਪੂਰਨ ਲੋਕ ਨਾਚ ਬਣ ਚੁੱਕਿਆ ਹੈ ਇਸ ਲਈ ਇਹ ਪੰਜਾਬੀ ਸੱਭਿਆ ਵਿੱਚ ਬਹੁਤ ਹੀ ਪ੍ਰਸਿੱਧ ਹੈ